ਅਸੀਂ ਭਾਰਤ ਹਿੰਦੁਸਤਾਨ ਇੰਡੀਆ ਕੀ ਹੈ ਇਹ ਦੁਨੀਆ ਦੀ ਇੱਕ ਬਹੁ ਕੀਮਤੀ ਇਹੋ ਜਿਹੀ ਇੱਕ ਦੌਲਤ ਹੈ ਪਹਿਲਾਂ ਕੀ ਕਹਿੰਦੇ ਸੀ ਅਸੀਂ ਅਮਰੀਕਾ ਸਾਰੀ ਦੁਨੀਆ 'ਤੇ ਰਾਜ ਕਰ ਰਿਹਾ ਅੱਜ ਕੱਲ ਕੀ ਹੈ ਅਮਰੀਕਾ ਭਾਰਤ ਤੋਂ ਪੁੱਛ ਕੇ ਸਾਰੇ ਕੰਮ ਕਰ ਰਿਹਾ ਅੱਜ ਤੱਕ ਜਿੰਨੇ ਵੀ ਗ੍ਰਹਿ 'ਤੇ ਦੂਜੇ ਗ੍ਰਹਿਆਂ 'ਤੇ ਜੋ ਵੀ ਅੱਜ ਤੱਕ ਜਿੰਨੀਆਂ ਵੀ ਖੋਜਾਂ ਹੋਈਆਂ ਸਾਰੇ ਦੂਜੇ ਦੇਸ਼ਾਂ ਨੇ ਕੀਤੀਆਂ ਸਾਡੀ ਪਹਿਲੀ ਜਿਹੜੀ ਹੈ ਭੈਣ ਹੈ ਕਲਪਨਾ ਚਾਵਲਾ ਉਹ ਦੂਜੇ ਗ੍ਰਹਿ 'ਤੇ ਜਾ ਕੇ ਆਪਣਾ ਸਭ ਕੁਛ ਨਿਸ਼ਾਵਰ ਕਰਕੇ ਆਪਣੇ ਭਾਰਤ ਦਾ ਨਾਂ ਰੋਸ਼ਨ ਕੀਤਾ ਸੁਨੀਤਾ ਵਿਲੀਅਮਸ ਹੈ ਠੀਕ ਹੈ ਉਹਦੇ ਨਾਲ ਨਾਲ ਰਕੇਸ਼ ਸ਼ਰਮਾ ਹੈ ਜਿਨ੍ਹਾਂ ਨੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ ਠੀਕ ਹੈ ਅਸੀਂ ਕੀ ਪਹਿਲਾਂ ਕੀ ਸੀ ਭਾਰਤ ਨੂੰ ਕੀ ਸਮਝਦੇ ਸੀ ਇੱਕ ਤੁਛ ਜਿਹਾ ਦੇਸ਼ ਸਮਝਦੇ ਸੀ ਪਰ ਅੱਜ ਸਾਰੀ ਦੁਨੀਆ ਜਿਹੜੀ ਹੈ ਭਾਰਤ ਤੋਂ ਸੇਧ ਲੈ ਕੇ ਸਾਰਾ ਕੰਮ ਕਰ ਰਹੀ ਹੈ ਭਾਰਤ ਨੇ ਇੱਕ ਪੁਰਾਣੇ ਸ਼ੁਰੂ ਤੋਂ ਜੋਗੀ ਮੁਨੀ ਸਾਰੇ ਕੰਮ ਕਰਦੇ ਆ ਰਹੇ ਸੀ ਹੁਣ ਕੀ ਹੋ ਰਿਹਾ ਉਹੀ ਯੁੱਗ ਆ ਜਿਹੜੀ ਚੱਲ ਰਹੀ ਹੈ ਉਹ ਭਾਰਤ ਦੇ ਨਾਲ ਨਾਲ ਪੂਰੇ ਦੇਸ਼ ਵਿੱਚ ਸਾਰੇ ਉਸਨੂੰ ਵਿਕਸਿਤ ਕਰ ਰਹੇ ਨੇ ਸਾਰੇ ਉਹਨੂੰ ਅਪਣਾ ਰਹੇ ਨੇ ਠੀਕ ਹੈ